ਪੰਜਾਬੀ ਲੋਕ ਆਪਣੇ ਸੱਭਿਆਚਾਰ ਦੀ ਵਿਰਾਸਤ ਨੂੰ ਮਨਾਉਣ ਦੇ ਲਈ ਬਹੁਤ ਹੀ ਜ਼ਿਆਦਾ ਠੱਠੇ ਠੇਰੇ ਕਰਦੇ ਹਨ ਜਿਵੇਂ ਕਿ ਪੰਜਾਬੀ ਸੱਭਿਆਚਾਰ ਮੇਲੇ ਲੱਗਦੇ ਹਨ ਥਾਉਂ ਥਾਈ ਜਗ੍ਹਾ ਜਗ੍ਹਾ 'ਤੇ ਇਸ ਸੱਭਿਆਚਾਰ ਦੇ ਮੇਲੇ ਕਰਵਾਏ ਜਾਂਦੇ ਹਨ ਜਿਸ ਦੇ ਵਿੱਚ ਸੱਭਿਆਚਾਰ ਬਾਰੇ ਦੱਸਿਆ ਜਾਂਦਾ ਹੈ ਤਸਵੀਰਾਂ ਰਾਹੀਂ ਕਹਾਣੀਆਂ ਰਾਹੀਂ ਕਵਿਤਾਵਾਂ ਰਾਹੀਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਸਾਜੋ ਸਮਾਨ ਦੇ ਰਾਹੀਂ ਜਿਵੇਂ ਕਿ ਫੁਲਕਾਰੀ ਕਸੀਦਾ ਘੜੇ ਬਣਾਉਣੇ ਮੰਜੇ ਉਣਨੇ ਨਾਲੇ ਬੁਣਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਨੇ ਤਾਂ ਕਿ ਲੋਕਾਂ ਨੂੰ ਆਪਣੇ ਵਿਰਾਸਤ ਬਾਰੇ ਪਤਾ ਲੱਗੇ ਅਤੇ ਸੱਭਿਆਚਾਰ ਬਾਰੇ ਪਤਾ ਲੱਗੇ ਸੱਭਿਆਚਾਰ ਪੰਜਾਬੀਆਂ ਦਾ ਇੱਕ ਅਣਮੁੱਲਾ ਗਹਿਣਾ ਹੈ ਜਿਹਦਾ ਮੁੱਲ ਕਦੇ ਪਾਇਆ ਨਹੀਂ ਜਾ ਸਕਦਾ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਹੱਥੀਂ ਬਣਾਈਆਂ ਤਸਵੀਰਾਂ ਤਸਵੀਰਾਂ ਕਾਹਦੀਆਂ ਸਾਡੇ ਸੱਭਿਆਚਾਰ ਦੇ ਰਾਜੇ ਮਹਾਰਾਜੇ ਦੀਆਂ ਸਾਡੀ ਵਿਰਾਸਤ ਦੀਆਂ ਮਹਿਲਾਂ ਦੀਆਂ ਗੁਰਦੁਆਰੇ ਦੀਆਂ ਅਤੇ ਜਿਵੇਂ ਕਿ ਮੇਲਿਆਂ ਦੀਆਂ ਤਸਵੀਰਾਂ ਕਹਾਣੀਆਂ ਹੀਰ ਰਾਂਝਾ ਸੱਸੀ ਪੰਨੂ ਸੋਹਣੀ ਮਹੀਵਾਲ ਇਹਨਾਂ ਦੀਆਂ ਕਹਾਣੀਆਂ ਦੁਆਰਾ ਸਾਡੇ ਸੱਭਿਆਚਾਰ ਨੂੰ ਬਿਆਨ ਕੀਤਾ ਜਾਂਦਾ ਹੈ ਝਲਕਾਂ ਦਿਖਾਈਆਂ ਜਾਂਦੀਆਂ ਨੇ ਕਿ ਸੋਹਣੀਆਂ ਮੁਟਿਆਰਾਂ ਕਿੱਦਾਂ ਦੀਆਂ ਹੁੰਦੀਆਂ ਨੇ ਕੰਨਾਂ ਦੇ ਵਿੱਚ ਬਾਲੀਆਂ ਪਾਈਆਂ ਹੁੰਦੀਆਂ ਨੇ ਪਿੱਪਲ ਪੱਤੀਆਂ ਬੰਨੀਆਂ ਹੁੰਦੀਆਂ ਨੇ ਫੁਲਕਾਰੀਆਂ ਲਈਆਂ ਹੁੰਦੀਆਂ ਨੇ ਪੰਜਾਬੀ ਪਹਿਰਾਵਾ ਪਾਇਆ ਹੁੰਦਾ ਹੈ ਸੱਗੀ ਫੁੱਲ ਲਾਏ ਹੁੰਦੇ ਨੇ ਇਹਨਾਂ ਦੇ ਅਲੱਗ ਅਲੱਗ ਰੰਗ ਮੰਚ ਲੱਗਦੇ ਨੇ ਕਿ ਕਿੱਦਾਂ ਦੀਆਂ ਮੁਟਿਆਰਾਂ ਦਿਖਦੀਆਂ ਨੇ ਅਤੇ ਗੱਭਰੂ ਕਿੱਦਾਂ ਦੇ ਦਿਖਦੇ ਨੇ ਮੇਲਿਆਂ ਦੇ ਵਿੱਚ ਜਿਵੇਂ ਗਲਾਂ 'ਚ ਕੈਂਠੇ ਪਾਏ ਹੁੰਦੇ ਨੇ ਕੁੜਤਾ ਪਜਾਮਾ ਪਾਇਆ ਹੁੰਦਾ ਹੈ ਲੰਬੇ ਲਾਂਝੇ ਕੱਦ ਹੁੰਦੇ ਨੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਨੇ ਜਿਸ ਨਾਲ ਕਿ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ ਜਾਂਦਾ ਹੈ ਖਾਣ ਪੀਣ ਦੇ ਲਾ ਖਾਣ ਪੀਣ ਦੇ ਵਜੋਂ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਦੇਸੀ ਘਿਓ ਅਤੇ ਲੱਸੀ ਹੋਰ ਵੀ ਕਰਾ ਕਈ ਤਰ੍ਹਾਂ ਦੀਆਂ ਕਿ ਜਿਵੇਂ ਖੇਤੀ ਪੰਜਾਬੀ ਆਪ ਕਰਦੇ ਨੇ ਖੇਤੀ ਦੇ ਵਿੱਚ ਵਰਤੇ ਜਾਣ ਵਾਲੇ ਸੰਦ ਸਾਜ ਕਿੱਦਾਂ ਦੇ ਹੁੰਦੇ ਨੇ ਅਤੇ ਉਹਨਾਂ ਦੇ ਕੀ ਕੀ ਕੰਮ ਹੁੰਦੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਉਹਨਾਂ ਦੀਆਂ ਤਸਵੀਰਾਂ ਵੀ ਦਰਸਾਈਆਂ ਜਾਂਦੀਆਂ ਹਨ ਕਈ ਤਰ੍ਹਾਂ ਦੇ ਮਿਊਜ਼ੀਅਮ ਬਣੇ ਹੋਏ ਨੇ ਸੱਭਿਆਚਾਰ ਜਿਨ੍ਹਾਂ ਦੇ ਵਿੱਚ ਝਲਕ ਉੱਠਦੀ ਹੈ ਜਿਨ੍ਹਾਂ ਦੀ